ਹਾਂਜੀ ਮੈਮ ਤੁਸੀਂ ਐੱਸ ਬੀ ਆਈ ਬੈਂਕ 'ਚੋਂ ਬੋਲ ਰਹੇ ਹਾਂਜੀ ਮੈਮ ਮੈਂ ਖਾਤਾ ਖੁਲਾਉਣਾ ਹੈ ਤੁਹਾਡੀ ਬੈਂਕ 'ਚ ਹਾਂਜੀ ਮੈਮ ਬਣਾਏ ਡੋਕੂਮੈਂਟ ਦਸ ਦਿਉ ਮੈਮ ਕਿਹੜੇ ਕਿਹੜੇ ਚਾਹੀਦੇ

ਹਾਂਜੀ ਹਾਂਜੀ ਠੀਕ ਹੈ ਮੈਮ ਹਾਂਜੀ

ਠੀਕ ਮੈਮ ਨਾਲੇ ਉਹ ਦੱਸਿਓ ਮਾੜਾ ਜਿਹਾ ਵੀ ਕਿੰਨੇ ਵਜੇ ਮੈਮ ਬੈਂਕ ਤੁਹਾਡੀ ਖੁੱਲ੍ਹ ਜਾਂਦੀ

ਠੀਕ ਹੈ ਮੈਮ ਹਾਂਜੀ ਹਾਂਜੀ

ਹਾਂਜੀ ਹਾਂਜੀ ਠੀਕ ਹੈ ਮੈਮ ਠੀਕ

ਹਾਂਜੀ ਹਾਂਜੀ ਮੈਮ ਕਰ ਲੈਣਾ

ਮੈਮ ਠੀਕ ਹੈ ਮੈਂ ਕੱਲ੍ਹ ਨੂੰ ਆਉਂਗਾ ਹਾਂਜੀ ਹਾਂਜੀ ਠੀਕ